ਹੋਰ ਗ੍ਰਹਿਾਂ 'ਤੇ ਜੀਵਨ ਦੇ ਮੁੱਦੇ ਦੇ ਵਿਗਿਆਨਿਕ ਸਾਨੂੰ ਦੱਸਦੇ ਰਹਿੰਦੇ ਹਨ ਮਹੱਤਵਪੂਰਨ ਅਧਾਰ ਅਤੇ ਕਾਰਨ ਦੱਸਦੇ ਹਨ ਜਿਸ ਨਾਲ ਸਾਨੂੰ ਵਿਗਿਆਨਿਕ ਸਹਾਰਾ ਮਿਲਦਾ ਹੈ ਗ੍ਰਹਿਾਂ 'ਤੇ ਰਹਿਣ ਦਾ ਅਤੇ ਇਹ ਸੰਕੇਤ ਬਹੁਤ ਸਾਰੇ ਗ੍ਰਹਿਾਂ 'ਤੇ ਜੀਵਨ ਸੰਭਾਵਨਾ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਸਾਡੇ ਗਲੈਕਸੀ ਵਿੱਚ ਬਹੁਤ ਸਾਰੇ ਟੈਕਨੋਲੋਜੀ ਸੰਚਾਰ ਕਰਨ ਵਾਲੇ ਸਾਲਾ ਸਾਰਾ ਅਤੇ ਗਿਣਤੀ ਦਾ ਅੰਦਾਜ਼ਾ ਲਗਾਉਣ ਵਿੱਚ ਬਣਾ ਕੇ ਇਹ ਸਾਨੂੰ ਪਤਾ ਗ ਸਾਨੂੰ ਗ੍ਰਹਿਾਂ ਬਾਰੇ ਜਾਣਕਾਰੀ ਹੁੰਦੀ ਆ ਹੋਰ ਗ੍ਰਹਿਾਂ 'ਤੇ ਜੀਵਨ ਹੈ ਉਹ ਸਾਡੇ ਨਾਲ ਸੰਪਰਕ ਵਿੱਚ ਨਹੀਂ ਨਹੀਂ ਆਵੇ ਇਸਦੇ ਜਵਾਬ ਵਿੱਚ ਸਿਧਾਂਤ ਕਿਉਂ ਜਿਵੇਂ ਕਿ ਹੋ ਸਕਦਾ ਹੈ ਸੱਤ ਸਵਾਈ ਸਵਾਈਲੇਸ਼ਨ ਆਪਣੇ ਨਾਲ ਖੁਦ ਕਰਕੇ ਗਲੈਕਸੀ ਜੀ ਸਾਡੇ ਕੋਲ ਬਹੁਤ ਦੂਰ ਹੈ ਗੋਲਡ ਗੋਲਡੀ ਟੈਕਸ ਜੋ ਇਸ ਸਿਧਾਂਤ ਦੇ ਅਨੁਸਾਰ ਜਿੰਨੇ ਗ੍ਰਹਿਾਂ 'ਤੇ ਜੀਵਨ ਹੋ ਸਕਦਾ ਉਹਨੇ ਆਪਣੇ ਸੂਰਜ ਤੋਂ ਠੀਕ ਦੂਰੀ ਤੋਂ ਹੋਣੇ ਚਾਹੀਦੇ ਹਨ ਉਹਨਾਂ ਦੇ ਉੱਪਰ ਪਾਣੀ ਅਤੇ ਤਰਲ ਪਦਾਰਥ ਹੋਣੇ ਚਾਹੀਦੇ ਹਨ ਜੋ ਮੌਜੂਦਾ ਸਾਨੂੰ ਰਹਿਤ ਇਹ ਸੀ ਉੱਥੇ ਸਿਧਾਂਤ ਅਨੁਸਾਰ ਜੀਵਨ ਦੀ ਸ਼ੁਰੂਆਤ ਧਰਤੀ ਤੋਂ ਇਲਾਵਾ ਕਿਸੇ ਹੋਰ ਜਗ੍ਹਾ 'ਤੇ ਵੀ ਹੋ ਸਕਦੀ ਹੈ